ਸਕੂਲ ਤੋਂ ਬਾਅਦ ਸ਼ਾਮ ਦੀਆਂ ਟਿਊਸ਼ਨਾਂ ਤਾਂ ਅੱਜ ਕੱਲ੍ਹ ਬਹੁਤ ਜ਼ਰੂਰੀ ਹੋ ਗਈਆਂ ਹਨ ਕਿਉਂਕਿ ਅੱਜ ਕੱਲ੍ਹ ਦੀਆਂ ਪੜ੍ਹਾਈਆਂ ਬਹੁਤ ਔਖੀਆਂ ਹਨ ਨਾਲ ਅੱਜ ਕੱਲ੍ਹ ਦੇ ਬੱਚੇ ਘਰ 'ਚ ਬਹੁਤ ਜ਼ਿਆਦਾ ਸ਼ਰਾਰਤਾਂ ਕਰਦੇ ਆ ਟਿਊਸ਼ਨਾਂ 'ਤੇ ਜਾਣ ਤਾਂ ਸਗੋਂ ਸਭ ਤੋਂ ਵਧੀਆ ਅਤੇ ਅੱਜ ਕੱਲ੍ਹ ਦੀਆਂ ਟਿਊਸ਼ਨਾਂ 'ਤੇ ਜਾਣਾ ਵੀ ਜ਼ਰੂਰੀ ਹੋ ਗਿਆ ਹੈ ਕਿਉਂਕਿ ਸਕੂਲੋਂ ਪੜ੍ਹ ਕੇ ਆਉਂਦੇ ਹੈ ਅੱਜ ਕੱਲ੍ਹ ਦੀਆਂ ਪੜ੍ਹਾਈਆਂ ਵੀ ਔਖੀਆਂ ਹੋਣ ਕਰਕੇ ਘਰ ਦੇ ਜਿਹੜੇ ਮਦਰ ਸੀਗੇ ਉਹ ਜ਼ਿਆਦਾਤਰ ਪੜ੍ਹਾ ਨਹੀਂ ਸਕਦੇ ਅਤੇ ਇਸੇ ਲਈ ਸਕੂਲੋਂ ਪੜ੍ਹ ਕੇ ਆਉਂਦੇ ਹੈ ਜਾ ਕੇ ਟਿਊਸ਼ਨਾਂ ਪੜ੍ਹਦੇ ਆ ਨਾਲ ਰਿਵਾਈਜ਼ ਹੋ ਜਾਂਦੀ ਹੈ ਪ੍ਰੈਕਟਿਸ ਹੋ ਜਾਂਦੀ ਹੈ ਚੰਗੇ ਮਾਰਕਸ ਆ ਜਾਂਦੇ ਹਨ ਟਿਊਸ਼ਨਾਂ ਜ਼ਰੂਰੀ ਵੀ ਹੋ ਗਈਆਂ ਹੋਈਆਂ ਵਾ ਪੜ੍ਹਾਈਆਂ ਬਹੁਤ ਔਖੀਆਂ ਹੋ ਗਈਆਂ ਅੱਜ ਕੱਲ੍ਹ ਦੀਆਂ ਪੜ੍ਹਾਈਆਂ ਬਹੁਤ ਸਭ ਇੰਗਲਿਸ਼ ਮੀਡੀਅਮ ਹੋ ਗਿਆ ਹੈ ਪਹਿਲੇ ਜਮਾਨੇ 'ਚ ਅਤੇ ਪੰਜਾਬੀ ਮੀਡ ਮੀਡੀਅਮ ਹੁੰਦਾ ਸੀ ਅੱਜ ਕੱਲ੍ਹ ਸਭ ਕੁਝ ਇੰਗਲਿਸ਼ ਜੋ ਹੋ ਗਿਆ ਹੋਇਆ ਵਾ ਬੱਚਿਆਂ ਦੀਆਂ ਟਿਊਸ਼ਨਾਂ ਵੀ ਲਾਜ਼ਮੀ ਹੋ ਗਈਆ ਨਾ ਪਰ ਅੱਜ ਕੱਲ੍ਹ ਟਿਊਸ਼ਨਾਂ ਦੀਆਂ ਫੀਸਾਂ ਵੀ ਬਹੁਤ ਜ਼ਿਆਦਾ ਹੋ ਗਈਆਂ ਹਨ ਅਤੇ ਇਸੇ ਲਈ ਟਿਊਸ਼ਨਾਂ ਜ਼ਰੂਰੀ ਹੈ ਬੱਚਿਆਂ ਲਈ ਸਕੂਲ ਤੋਂ ਬਾਅਦ ਟਿਊਸ਼ਨ ਜਾਣਾ ਨਾਲ ਟਾਈਮ ਸਪੈਂਡ ਹੋ ਜਾਂਦਾ ਹੈ ਬੱਚਿਆਂ ਦਾ ਧਿਆਨ ਇੱਧਰ ਉੱਧਰ ਖੇਡਾਂ ਤੋਂ ਇਲਾਵਾ ਫਾਲਤੂ ਗੱਲਾਂ ਕਰਨ ਤੋਂ ਇਲਾਵਾ ਟਿਊਸ਼ਨਾਂ ਵਿੱਚ ਜਾ ਕੇ ਪੜ੍ਹਦੇ ਹਨ ਬਾਅਦ ਵਿੱਚ ਖੇਡਣ ਆਪਣੀ ਮੌਜ ਮਸਤੀ ਕਰਨ ਉਹ ਵੀ ਉਹਨਾਂ ਲਈ ਪਰਫੈਕਟ ਹੈਗਾ ਵਾ ਇਸੇ ਲਈ ਟਿਊਸ਼ਨਾਂ 'ਚ ਜਾਣ ਆਪਣਾ ਪੜ੍ਹਨ ਆਪਣਾ ਜ਼ਿੰਦਗੀ ਨੂੰ ਸੋਹਣਾ ਬਣਾਉਣ ਸਕੂਲ ਜਾਂ ਸਕੂਲ ਜੋ ਸਟੱਡੀ ਕਰਕੇ ਉਹਨੂੰ ਟਿਊਸ਼ਨਾਂ 'ਚ ਜਾ ਕੇ ਚੰਗੀ ਤਰ੍ਹਾਂ ਰਿਵਾਈਜ਼ ਕਰਨ ਅਤੇ ਇਸੇ ਲਈ ਉਨ੍ਹਾਂ ਦੀ ਸਟੱਡੀ ਬੇਸ ਵੀ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਪੜ੍ਹਾਈ ਵਿੱਚ ਮੈਂ ਇੰਟੈਲੀਜੈਂਟ ਹੋ ਜਾਂਦੇ ਹਨ ਓਕੇ ਜੀ